ਮੈਂ ਜ਼ਿਲ੍ਹਾਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਇੱਥੇ ਕਈ ਤਰ੍ਹਾਂ ਦੇ ਤੀਰਥ ਸਥਾਨ ਪਾਏ ਜਾਂਦੇ ਹਨ ਜਿਵੇਂ ਕਿ ਗੋਲਡਨ ਟੈਂਪਲ ਜਿਹਨੂੰ ਅਸੀਂ ਸ੍ਰੀ ਦਰਬਾਰ ਸਾਹਿਬ ਵੀ ਕਹਿੰਦੇ ਹਾਂ ਦੂਸਰਾ ਇੱਥੇ ਪ੍ਰਮੁੱਖ ਤੀਰਥ ਸਥਾਨ ਦੁਰਗਿਆਣਾ ਮੰਦਿਰ ਹਿੰਦੂਆਂ ਦਾ ਬਹੁਤ ਹੀ ਵੱਡਾ ਮੰਦਿਰ ਹੈ ਤੀਸਰਾ ਇੱਥੇ ਰਾਮ ਤੀਰਥ ਬਹੁਤ ਹੀ ਪ੍ਰਸਿੱਧ ਮੰਦਿਰ ਹੈ ਜਿੱਥੇ ਲਵ ਕੁਸ਼ ਆ ਕੇ ਰਹੇ ਸਨ ਇੱਥੇ ਬਹੁਤ ਹੀ ਹੋਰ ਬਹੁਤ ਹੀ ਹੋਰ ਮੰਦਿਰ ਅਤੇ ਗੁਰਦੁਆਰੇ ਹਨ ਜਿਨ੍ਹਾਂ ਵਿੱਚੋਂ ਇੱਕ ਸ਼ਹੀਦਾਂ ਸਾਹਿਬ ਵੀ ਹੈ ਇੱਥੋਂ ਦੇ ਲੋਕ ਉੱਥੇ ਬਹੁਤ ਜਾਂਦੇ ਹਨ ਇੱਥੇ ਸਭ ਭਾਈਚਾਰੇ ਦੇ ਨਾਲ ਰਹਿੰਦੇ ਹਨ ਹਿੰਦੂ ਅਤੇ ਸਿੱਖ ਉਹਨਾਂ ਦੇ ਵਿੱਚ ਬਹੁਤ ਹੀ ਪਿਆਰ ਹੈ ਹਿੰਦੂ ਸਿੱਖਾਂ ਦੇ ਗੁਰਦੁਆਰੇ ਵੀ ਜਾਂਦੇ ਹਨ ਅਤੇ ਸਿੱਖ ਹਿੰਦੂਆਂ ਦੇ ਤੀਰਥ ਸਥਲਾਂ ਦੇ ਉੱਤੇ ਵੀ ਬਹੁਤ ਵੱਡੀ ਪੱਧਰ 'ਤੇ ਜਾਂਦੇ ਹਨ ਇਸ ਦੇ ਵਿੱਚ ਸਾਲ ਦੇ ਵਿੱਚ ਬਹੁਤ ਹੀ ਵੱਡਾ ਤਿਉਹਾਰ ਦੀਵਾਲੀ ਮਨਾਇਆ ਜਾਂਦਾ ਹੈ ਦੀਵਾਲੀ ਹਿੰਦੂ ਰਾਮ ਚੰਦਰ ਜੀ ਦੇ ਬਣਵਾਸ ਤੋਂ ਵਾਪਿਸ ਆਉਣ ਕਰਕੇ ਮਨਾਉਂਦੇ ਹਨ ਅਤੇ ਸਿੱਖ ਲੋਕ ਇੱਥੇ ਜੋ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਮਨਾਉਂਦੇ ਹਨ